ਮੈਨੂੰ ਖੁਦ ਨੂੰ ਤਾਂ ਤੈਰਾਕੀ ਦਾ ਕੋਈ ਤਜ਼ਰਬਾ ਨਹੀਂ ਹੈਗਾ ਪਰ ਮੈਂ ਕਿਤੇ ਪੜ੍ਹਿਆ ਹੈ ਮਤਲਬ ਕਿਤਾਬਾਂ ਦੇ ਵਿੱਚ ਪੜ੍ਹਿਆ ਹੈ ਕਿ ਜੇ ਕਿਸੇ ਬੰਦੇ ਨੂੰ ਤੈਰਾਕੀ ਨਹੀਂ ਆਉਂਦੀ ਜਾਂ ਉਹ ਪਹਿਲੀ ਵਾਰ ਜਿਹੜਾ ਤੈਰਨ ਲੱਗਿਆ ਪਾਣੀ ਦੇ ਵਿੱਚ ਤਾਂ ਉਸ ਨੂੰ ਜਾਂ ਤਾਂ ਟਿਊਬ ਲੈ ਕੇ ਤਾਂ ਤੈਰਨਾ ਹੀ ਚਾਹੀਦਾ ਅਤੇ ਇਸ ਤੋਂ ਇਲਾਵਾ ਉਸ ਨੂੰ ਗਰੁੱਪ ਦੇ ਵਿੱਚ ਜਿਹੜਾ ਤੈਰਨਾ ਚਾਹੀਦਾ ਤਾਂ ਕਿ ਜਿਹੜੇ ਬੰਦੇ ਨੂੰ ਨਾਲ ਦੇ ਨੂੰ ਤੈਰਾਕੀ ਆਉਂਦੀ ਹੈ ਤਾਂ ਉਹਨੂੰ ਬਚਾ ਸਕੇ ਕਿਉਂਕਿ ਨਹੀਂ ਤਾਂ ਜੇ ਉਹ ਪਹਿਲੀ ਵਾਰੀ ਤੈਰਾਕੀ ਕਰਨ ਲੱਗਿਆ ਇਕੱਲਾ ਹੈ ਤਾਂ ਉਹ ਉੱਥੇ ਡੁੱਬ ਵੀ ਸਕਦਾ ਉਹਨੂੰ ਇਹ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਕਿਉਂਕਿ ਤਿਲਕਣ ਵਾਲੀਆਂ ਚਟਾਨਾਂ ਵੀ ਹੁੰਦੀਆਂ ਨੇ ਖੁੱਲ੍ਹੇ ਪਾਣੀ ਦੇ ਵਿੱਚ ਇਸ ਲਈ ਉਹਨੂੰ ਇਹ ਸਾਵਧਾਨੀ ਜਿਹੜੀ ਜ਼ਰੂਰ ਵਰਤਣੀ ਚਾਹੀਦੀ ਕਿ ਉਹਨੂੰ ਇਕੱਲੇ ਨੂੰ ਤੈਰਾਕੀ ਨਹੀਂ ਕਰਨੀ ਚਾਹੀਦੀ ਹੈਗੀ ਨਾਲ ਕੋਈ ਟਰੇਂਡ ਜਿਹੜਾ ਬੰਦਾ ਹੋਣਾ ਜ਼ਰੂਰੀ ਆ